ਸਕੂਲਾਂ ਅਤੇ ਕਾਲਜਾਂ ਵਿੱਚ ਵਿੱਦਿਆ ਪ੍ਰਾਪਤ ਕਰਨ ਦੇ ਨਾਲ ਨਾਲ ਤਿੰਨ ਮਨੋਰਥ ਦਿੱਤੇ ਜਾਂਦੇ ਹਨ ਇੱਕ ਬੌਧਿਕ ਵਿਕਾਸ ਸਰੀਰਕ ਵਿਕਾਸ ਅਤੇ ਸੱਦਿਆਚਾਰਕ ਗੁਣਾਂ ਦੀ ਉਸਾਰੀ ਜਿੱਥੇ ਖੇਡਾਂ ਸਾਡੇ ਸਰੀਰਕ ਵਿਕਾਸ 'ਚ ਆਪਣਾ ਵਿਸ਼ੇਸ਼ ਯੋਗਦਾਨ ਪਾਉਂਦੀਆਂ ਹਨ ਉਸੇ ਤਰ੍ਹਾਂ ਹੀ ਖੇਡਾਂ ਦੇ ਨਾਲ ਨਾਲ ਅ ਅਗਰ ਵਿਦਿਆਰਥੀ ਯੋਗਾ ਵੱਲ ਨੂੰ ਪ੍ਰੇਰਿਤ ਹੋਣ ਤਾਂ ਹੋਰ ਵੀ ਵਧੀਆ ਗੱਲ ਹੈ ਯੋਗਾ ਸਿਰਫ਼ ਵਿਦਿਆਰਥੀਆਂ ਲਈ ਹੀ ਨਹੀਂ ਹੈ ਹਰ ਔਰਤ ਲਈ ਮਰਦ ਲਈ ਬੱਚਿਆਂ ਲਈ ਸਾਰਿਆਂ ਲਈ ਹੀ ਬਹੁਤ ਮਹੱਤਵਪੂਰਨ ਚੀਜ਼ ਹੈ ਯੋਗਾ ਕਰਨ ਦੇ ਨਾਲ ਸਾਡੇ ਸਰੀਰ ਦੀ ਇਕ ਇਕ ਨਾੜੀ ਦੇ ਵਿੱਚ ਸਾਡੇ ਖੂਨ ਦਾ ਪ੍ਰਵਾਹ ਠੀਕ ਹੁੰਦਾ ਹੈ ਸਾਡੇ ਵਿਅਕਤੀਗਤ ਵਿਕਾਸ ਲਈ ਯੋਗਾ ਬਹੁਤ ਹੀ ਮਹੱਤਵਪੂਰਨ ਚੀਜ਼ ਹੈ ਅੱਜ ਕੱਲ੍ਹ ਹਰ ਸ਼ਹਿਰ ਵਿੱਚ ਹਰ ਪਾਰਕ ਵਿੱਚ ਯੋਗਾ ਦੇ ਅਭਿਆਸ ਚਲਦੇ ਹਨ ਵੱਖਰੇ ਵੱਖਰੇ ਯੋਗਾ ਟੀਚਰ ਆ ਕੇ ਉੱਥੇ ਸਵੇਰੇ ਸ਼ਾਮ ਯੋਗਾ ਸਿਖਾਉਂਦੇ ਹਨ ਜਿਹਦੇ ਨਾਲ ਕੇ ਘਰ ਘਰ ਦੀਆਂ ਔਰਤਾਂ ਘਰੇਲੂ ਔਰਤਾਂ ਜਿਹੜੀਆਂ ਕਿ ਆਪਣੇ ਘਰਾਂ ਦੇ ਕੰਮਾਂ ਤੋਂ ਵੇਹਲੇ ਹੋ ਕੇ ਆਪਣੇ ਸਰੀਰ ਵੱਲ ਨਹੀਂ ਵੇਖ ਪਾਉਂਦੀਆਂ ਕਈ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੀਆਂ ਹਨ ਉਹਨਾਂ ਨੂੰ ਇਨਾ ਚੀਜ਼ਾਂ ਦੇ ਨਾਲ ਬਹੁਤ ਮਦਦ ਮਿਲ ਰਹੀ ਹੈ ਜਿਹੜੀ ਕਿ ਅ ਜਦੋਂ ਵੀ ਉਹਨਾਂ ਦਾ ਟਾਈਮ ਲੱਗਦਾ ਹੈ ਜਦੋਂ ਵੀ ਉਹ ਆਪਣੇ ਘਰ ਦੇ ਕੰਮਾਂ ਤੋਂ ਵਿਹਲੀਆਂ ਹੁੰਦੀਆਂ ਹਨ ਉਹ ਆਪੇ ਆਪਣੇ ਘਰ ਵਿੱਚ ਹੀ ਯੋਗਾ ਕਰਕੇ ਆਪਣੇ ਆਪ ਨੂੰ ਤੰਦਰੁਸਤ ਕਰਨ ਲੱਗੀਆਂ ਹਨ ਮਟ ਯੋਗਾ ਦੇ ਨਾਲ ਮੋਟਾਪੇ ਤੋਂ ਬਹੁਤ ਜਲਦੀ ਛੁਟਕਾਰਾ ਮਿਲਦਾ ਹੈ ਇਹ ਸਾਨੂੰ ਆਪਣੇ ਅੰਦਰ ਦੀ ਆਪਣੇ ਅੰਦਰ ਨੂੰ ਭਾਲਣ ਲਈ ਉਹਦੇ ਵਿੱਚ ਬਹੁਤ ਸਾਡੀ ਮਦਦ ਕਰਦੀਆਂ ਹਨ ਅਸੀਂ ਦਿਮਾਗੀ ਤੌਰ 'ਤੇ ਪਰੇਸ਼ਾਨੀਆ ਸਭ ਭੁੱਲ ਜਾਂਦੇ ਹਾਂ ਯੋਗਾ ਦੇ ਨਾਲ ਸਾਡੇ ਹਰ ਇੱਕ ਨਾੜੀ ਦੇ ਵਿੱਚ ਹਰ ਇੱਕ ਸਰੀਰ ਦੇ ਅੰਗ ਦੇ ਵਿੱਚ ਖੂਨ ਦਾ ਪ੍ਰਵਾਹ ਬਿਲਕੁਲ ਠੀਕ ਹੋ ਜਾਂਦਾ ਜਿਹਦੇ ਨਾਲ ਸਾਡਾ ਦਿਮਾਗ ਦਿਲ ਸਾਡੇ ਫੇਫੜੇ ਸਭ ਆਪਣੇ ਆਪਣੇ ਕੰਮਾਂ 'ਤੇ ਠੀਕ ਲੱਗੇ ਰਹਿੰਦੇ ਹਨ ਜਿਹਦੇ ਨਾਲ ਕਿ ਸਾਡਾ ਸਰੀਰ ਤੰਦਰੁਸਤ ਰਹਿੰਦਾ ਹੈ ਯੋਗਾ ਦਾ ਸਾਡੇ ਸਰੀਰ ਦੇ ਵਿੱਚ ਬਹੁਤ ਮਹੱਤਵਪੂਰਨ ਹਿੱਸਾ ਹੈ